ਬੈਂਕ ਦੇ ਨਾਲ ਹਮੇਸ਼ਾ ਹੀ ਕੋਈ ਨਾ ਕੋਈ ਸਮੱਸਿਆ ਆ ਜਾਂਦੀ ਹੈ ਕਿਉਂਕਿ ਬੈਂਕ ਦੇ ਭੁਗਤਾਨ ਦੇ ਵਿੱਚ ਅਤੇ ਬੈਂਕ ਦੇ ਨਾਲ ਲੈਣ ਦੇਣ ਕਰਨ ਦੇ ਦੌਰਾਨ ਕਈ ਤਰ੍ਹਾਂ ਦੀਆਂ ਨਵੇਂ ਨਵੇਂ ਰੂਲ ਨਵੇਂ ਨਵੇਂ ਵੇਰਵੇ ਆਉਣ ਦੇ ਕਾਰਨ ਟੈਕਸ ਦੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਅਤੇ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਵਿਆਜ ਦਰਾਂ ਦੇ ਆਉਣ ਦੇ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਹੋ ਜਾਂਦੀਆਂ ਹਨ ਅਤੇ ਇਹਨਾਂ ਦੀ ਜਿਹੜੀ ਸ਼ਿਕਾਇਤ ਹੈ ਅਸੀਂ ਜਾਂ ਤਾਂ ਬੈਂਕ ਦੇ ਮੈਨੇਜਰ ਨਾਲ ਕਰਦੇ ਹਾਂ ਜਾਂ ਉਹਨਾਂ ਦੇ ਕੈਸ਼ੀਅਰ ਨੂੰ ਕਰਦੇ ਹਾਂ ਜਾਂ ਉਹਨਾਂ ਦੇ ਕੁਝ ਅੱਛੇ ਜਿਹੜੇ ਸੀਨੀਅਰ ਸਟਾਫ ਮੈਂਬਰ ਹੁੰਦੇ ਹਨ ਉਹਨਾਂ ਨਾਲ ਕਰਦੇ ਹਨ ਪਰ ਬੈਂਕ ਦੇ ਮ ਬਹੁਤਾਤ ਮੁਲਾਜ਼ਮ ਜਿਹੜੇ ਹਨ ਉਹ ਚੰਗੇ ਹਨ ਅਤੇ ਗੱਲ ਦਾ ਛੇਤੀ ਤੋਂ ਛੇਤੀ ਮਸਲੇ ਦਾ ਨਿਵਾਰਨ ਕਰਦੇ ਹਨ ਮਸਲਾ ਕੋਈ ਵੀ ਹੋਵੇ ਬੈਂਕ ਦੇ ਦੌਰਾਨ ਬੈਂਕ 'ਚ ਹਰ ਇੱਕ ਕਿਸੇ ਨੂੰ ਆਪਣੇ ਬੈਂਕ ਦੇ ਵਿੱਚ ਪਏ ਪੈਸਿਆਂ ਦੀ ਫਿਕਰ ਹੁੰਦੀ ਹੈ ਆਪਣੇ ਬੈਂਕ 'ਚ ਪਏ ਆਪਣੇ ਸਮਾਨ ਦੀ ਫਿਕਰ ਹੁੰਦੀ ਹੈ ਤਾਂ ਇਸ ਲਈ ਉਹ ਆਪਣੇ ਆਪਣੀ ਸ਼ਿਕਾਇਤ ਦਾ ਨਿਵਾਰਨ ਜਲਦੀ ਤੋਂ ਜਲਦੀ ਚਾਹੁੰਦਾ ਹੈ ਇਸ ਲਈ ਕਈ ਤਰ੍ਹਾਂ ਦੀਆਂ ਸਰਕਾਰ ਵੱਲੋਂ ਵੀ ਹੈਲਪਲਾਈਨ ਨੰਬਰ ਜਾਰੀ ਕੀਤੇ ਹੋਏ ਹਨ ਕਈ ਤਰ੍ਹਾਂ ਦੇ ਰਿਜ਼ਰਵ ਬੈਂਕ ਵੱਲੋਂ ਵੀ ਨੰਬਰ ਜਾਰੀ ਕੀਤੇ ਹੋਏ ਹਨ ਉਹਨਾਂ ਦੇ ਉੱਤੇ ਵੀ ਮਦਦ ਲਈ ਜਾ ਸਕਦੀ ਹੈ ਪਰ ਬੈਂਕ ਦੇ ਸਟਾਫ ਅਤੇ ਮੈਨੇਜਰ ਦੇ ਨਾਲ ਹੀ ਮਿਲ ਕੇ ਸਹੀ ਤਰੀਕੇ ਦੀ ਸਹੀ ਸਮੇਂ 'ਤੇ ਸਹੀ ਮਦਦ ਜਿਹੜੀ ਹੈ ਉਹ ਲਈ ਜਾ ਸਕਦੀ ਹੈ ਮੈਨੂੰ ਹਮੇਸ਼ਾ ਹੀ ਬੈਂਕ ਦੇ ਮੁਲਾਜ਼ਮਾਂ ਵੱਲੋਂ ਬੈਂਕ ਮੈਨੇਜਰਾਂ ਵੱਲੋਂ ਅਤੇ ਬੈਂਕ ਦੀਆਂ ਬਰਾਂਚਾਂ ਵੱਲੋਂ ਸਹੀ ਸਮੇਂ 'ਤੇ ਸਹੀ ਮਦਦ ਮਿਲਦੀ ਰਹੀ ਹੈ